ਮੈਂਨੂੰ ਜਿਹੜੀ ਚੀਜ਼ ਤੋਂ ਖੁਸ਼ੀ ਮਿਲਦੀ ਹੈ ਉਹ ਦੂਜਿਆਂ ਦੀ ਮਦਦ ਕਰਕੇ ਮਿਲਦੀ ਹੈ ਮੈਂ ਜ਼ਰੂਰਤਮੰਦਾਂ ਨੂੰ ਮੇਰੇ ਤੋਂ ਜਿੰਨਾ ਕੁ ਵੀ ਹੋ ਸਕਦਾ ਮੈਂ ਉੱਨੀ ਕੁ ਮਦਦ ਜ਼ਰੂਰ ਕਰਦਾਂ ਮੈਂ ਜੇਕਰ ਕਿਸੇ ਨੂੰ ਦਵਾਈਆਂ ਦੀ ਲੋੇੜ ਹੈ ਗਰੀਬ ਪਰਿਵਾਰ ਹੈ ਕੋਈ ਜੇਕਰ ਉਨ੍ਹਾਂ ਤੋ ਨਹੀਂ ਲੈ ਹੁੰਦੀਆਂ ਜਿੰਨੀਆਂ ਕੁ ਹੋ ਸਕਦਾ ਮੈੈਂ ਜਿੰਨੀ ਕੁ ਲੈ ਕੇ ਦੇ ਸਕਦਾ ਮੈਂ ਦਵਾਈਆਂ ਲੈ ਕੇ ਦਿੰਦਾ ਅਤੇ ਜਿਹਨੂੰ ਕੋਈ ਥੋੜ੍ਹੇ ਬਹੁਤੇ ਪੈਸਿਆਂ ਦੀ ਲੋੜ ਹੈ ਅਤੇ ਮੈਂ ਉਨ੍ਹਾਂ ਨੂੁੰ ਪੈਸੇ ਦਿੰਦਾ ਉਨ੍ਹਾਂ ਦੀ ਥੋੜ੍ਹੀ ਜਿਹੀ ਮਦਦ ਕਰਕੇ ਉਨ੍ਹਾਂ ਨੂੰ ਖੁਸ਼ ਦੇਖ ਕੇ ਮੈਨੂੰ ਖੁਦ ਨੂੰ ਖੁਦ ਨੂੰ ਫੀਲਿੰਗ ਬਹੁਤ ਵਧੀਆ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਕਿਸੇ ਦੀ ਮਦਦ ਕਰੀ ਹੈ ਅਤੇ ਉਹ ਖੁਸ਼ ਹੈ ਮੇਰੀ ਵਜ੍ਹਾ ਤੋਂ ਅੱਜ ਇੱਥੇ ਮੈਨੂੰ ਉਹ ਅਸੀਸਾਂ ਦੇ ਰਿਹਾ ਅਤੇ ਇਹ ਚੀਜ਼ ਤੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ